ਹੈਲੋ ਅਮਨ ਕਾਲੜਾ ਬੋਲ ਰਿਹਾ ਸਰ ਸਭ ਸਭ ਠੀਕ ਸਰ ਬਸ ਝੋਨਾ ਆਇਆ ਜੀ ਹੁਣ ਜੀ ਅਸੀਂ ਪਰਮਲ ਵੀ ਬੀਜਿਆ ਥੋੜ੍ਹਾ ਜਿਹਾ ਬਾਸਮਤੀ ਵੀ ਹੈਗਾ ਸੱਠ ਮਣ ਕਿੱਲੇ ਦਾ ਅੱਗੇ ਤੁਸੀਂ ਦੱਸੋ ਤੁਹਾਡੇ ਤੋਂ ਤਾਂ ਤੁਹਾਨੂੰ ਤਾਂ ਹੀ ਫੋਨ ਕੀਤਾ ਤੁਸੀਂ ਸਿਆਣੇ ਬੰਦੇ ਹੈਗੇ ਦੱਸੋਗੇ ਸਾਨੂੰ ਕੀ ਕਰੀਏ ਵੇਚਤਾ ਜੀ ਝੋਨਾ ਪਰਮਲ ਦਸ ਕਿੱਲੇ ਅਸੀਂ ਤਾਂ ਕਣਕ ਬੀਜਣੀ ਹੈ ਸਾਡਾ ਤਾਂ ਕਣਕ ਬੀਜਣ ਦਾ ਹੈਗਾ ਵਿਚਾਰ ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਅਠਾਈ ਇੱਕਵੰਜਾ ਤੁਸੀਂ ਬੀਜ ਖਰੀਦ ਲਿਆ ਅੱਛਾ ਅੱਛਾ ਓਕੇ ਓਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਕਹਿੰਦਾ ਸ਼ਾਮ ਨੂੰ ਬੈਠਦੇ ਹਾਂ ਸਰ ਪ ਬਾਰੇ ਗੱਲ ਕਰਾਂਗੇ ਤੁਹਾਡੇ ਕੋਲ ਆ ਜਾਂਦਾ ਅੱਜ ਹੀ ਆ ਜਾਂਦਾ ਠੀਕ ਹੈ ਠੀਕ ਹੈ ਸਰ